ਬੁੱਕਸ ਪੜ੍ਹਨ ਦਾ ਮੈਨੂੰ ਸ਼ੌਕ ਸ਼ੁਰੂ ਤੋਂ ਰਿਹਾ ਹੈ ਬਚਪਨ ਤੋਂ ਹੀ ਪੜ੍ਹਾਈ ਤੋਂ ਇਲਾਵਾ ਵੀ ਮੈਂ ਹੋਰ ਇੱਧਰ ਉੱਧਰ ਬੁੱਕਸ ਨੂੰ ਦੇਖਦਾ ਰਹਿੰਦਾ ਸੀ ਕੋਈ ਅਲਗ ਅਲਗ ਟੌਪਿਕਸ 'ਤੇ ਅਤੇ ਮੈਨੂੰ ਆਪਣੇ ਪਿੱਛੇ ਜਿਹੇ ਮੌਕਾ ਮਿਲਿਆ ਭਗਵਤ ਗੀਤਾ ਅ ਜਿਹੜੀ ਕਿ ਇਸਕਾਉਣ ਵਾਲਿਆਂ ਦੀ ਪ੍ਰਭੂ ਪਾਦਾ ਜੀ ਦੁਆਰਾ ਲਿਖਿਤ ਹੈ ਉਹ ਪੜ੍ਹਨ ਦਾ ਮੌਕਾ ਮਿਲਿਆ ਥੋੜ੍ਹਾ ਜਿਹਾ ਪੜ੍ਹਨ ਕੇ ਮੈਂ ਇਤਨਾ ਇੰਮਪਰੈਸ ਹੋਇਆ ਕਿ ਮੈਂ ਉਹਨੂੰ ਲੈਣ ਦੀ ਆਪਣੀ ਇੱਛਾ ਮੇਰੀ ਹੋਈ ਅਤੇ ਇਸ ਵਾਸਤੇ ਮੈਂ ਕਿਸੇ ਕੋਲੋਂ ਸਲਾਹ ਲਿੱਤੀ ਮੈਨੂੰ ਗਾਈਡ ਕੀਤਾ ਗਿਆ ਕਿ ਤੁਹਾਨੂੰ ਆਪਣੇ ਨੇੜੇ ਮੰਦੀ ਰਿਸਕੋਨ ਤੋਂ ਹੀ ਇਹ ਅਵੇਲੇਬਲ ਹੋ ਸਕਦੀ ਹੈ ਅਤੇ ਮੈਂ ਉੱਥੇ ਗਿਆ ਉੱਥੇ ਇੱਕ ਸੀਨੀਅਰ ਜਿਹੜੇ ਉਹਨਾਂ ਦੇ ਮੈਂਬਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ਼ਨ ਕਰਕੇ ਮੈਨੂੰ ਹੋਰ ਜ਼ਿਆਦਾ ਸੈਟਿਸਫਾਈਡ ਫੀਲ ਹੋਇਆ ਕਿ ਹਾਂ ਇਹ ਸੱਚਮੁੱਚ ਬੜੀ ਗਿਆਨ ਵਾਲੀ ਬੁੱਕ ਮੇਰੇ ਵਾਸਤੇ ਬੜੀ ਫਾਇਦਾਮੰਦ ਹੋ ਸਕਦੀ ਹੈ ਔਰ ਜਿਹਦੇ ਵਿੱਚ ਕਿ ਕਹਿ ਸਕਤੇ ਹੈ ਏਮ ਐਂਡ ਆਰਟ ਔਫ ਲਿਵਿੰਗ ਇਹ 'ਚ ਅੱਛੀ ਤਰ੍ਹਾਂ ਡਿਸਕਰਾਈਬ ਕੀਤਾ ਗਿਆ ਇਸ ਇੱਛਾ ਦੇ ਨਾਲ ਫਿਰ ਮੈਂ ਉੱਥੇ ਉਸ ਚੀਜ਼ ਨੂੰ ਖਰੀਦਣ ਦਾ ਫੈਸਲਾ ਕੀਤਾ ਅਤੇ ਉੱਥੋਂ ਮੈਨੂੰ ਇੱਕ ਬੜੇ ਜੈਨੂਅਨ ਰੇਟ ਉੱਤੇ ਉਹ ਬੁੱਕ ਮਿਲ ਗਈ ਅਤੇ ਹੁਣ ਮੈਂ ਉਸਨੂੰ ਕਾਫੀ ਹੱਦ ਤੱਕ ਪੜ੍ਹ ਚੁੱਕਾ ਮੈਂ ਔਰ ਉਹਦੇ ਵਿੱਚ ਇੱਕ ਕਾਫੀ ਚੀਜ਼ਾਂ ਮੈਨੂੰ ਸਮਝਣ ਨੂੰ ਮਿਲੀਆਂ ਵੀਆਂ ਇੱਕ ਸੀਨੀਅਰਸ ਦੀ ਗਾਈਡੈਂਸ ਵਿੱਚ ਮੈਂ ਉਸ ਦੀ ਜਾਣਕਾਰੀ ਇਕੱਠੀ ਕਰ ਰਿਹਾ ਵੈ ਅਤੇ ਬਲਕਿ ਮੈਂ ਆਪਣੇ ਆਪ ਨੂੰ ਸੱਚਮੁੱਚ ਸਮਝ ਰਿਹਾ ਕਿ ਇਹ ਮੇਰੇ ਬਾਕੀ ਏਮ ਐਂਡ ਆਰਟ ਔਫ ਲਿਵਿੰਗ ਜਿਹੜਾ ਉਹਦਾ ਜਿਹੜਾ ਮੈਨੂੰ ਸਮਝਾਇਆ ਗਿਆ ਸੀ ਸਚਮੁੱਚ ਉਸ ਵਾਸਤੇ ਇੱਕ ਬੜੀ ਪਰਫੈਕਟ ਜਿਹੜੀ ਹੈ ਗਿਆਨ ਪੁਸਤਕਾ ਹੈ ਔਰ ਪ੍ਰਭੂ ਪਾਦਾ ਜੀ ਨੇ ਇਸ ਨੂੰ ਬੜੀ ਅੱਛੀ ਤਰ੍ਹਾਂ ਨਾਲ ਐਕਸਪਲੇਨ ਕੀਤਾ ਐਮ ਸੋ ਮੱਚ ਸੈਟਿਸਫਾਈਡ ਵਿਧ ਇਟ